ਮੇਰੀ ਹਰ ਸਮੇਂ ਦੀ ਮਨਪਸੰਦ ਦਾ ਖੇਡ ਇੱਕੋ ਹੀ ਹੈ ਜੋ ਕਿ ਕ੍ਰਿਕਟ ਹੈ ਜੋ ਕਿ ਮੈਨੂੰ ਕਿਸੇ ਵੀ ਟਾਈਮ ਕਦੀ ਵੀ ਕਿਤੇ ਵੀ ਆਵਾਜ਼ ਦਿੱਤੀ ਜਾਏ ਮੈਂ ਖੇਡਣ ਤੋਂ ਇਨਕਾਰ ਨਹੀਂ ਕਰ ਪਾਉਂਦਾ ਚਾਹੇ ਉਹ ਸਵੇਰ ਦੇ ਚਾਰ ਵਜੇ ਹੋਣ ਅਤੇ ਸ਼ ਚਾਹੇ ਸ਼ਾਮ ਦੇ ਚਾਰ ਵਜੇ ਹੋਣ ਚਾਹੇ ਕੜਕ ਦੀ ਧੁੱਪ ਹੋਵੇ ਅਤੇ ਚਾਹੇ ਬਹੁਤ ਹੀ ਜ਼ਿਆਦਾ ਸਰਦੀ ਪੈਂਦੀ ਹੋਵੇ ਉਹ ਚੀਜ਼ ਐਸੀ ਹੈ ਜਿਸ ਲਈ ਮੇਰੇ ਕੋਲ ਕਦੀ ਵੀ ਨਾ ਨਹੀਂ ਕੀਤੀ ਜਾਂਦੀ ਮੇਰੇ ਘਰ ਪੰਜ ਤਰ੍ਹਾਂ ਦੇ ਬੈਟ ਵੀ ਮਿਲਦੇ ਪਏ ਹੋਏ ਹਨ ਅਤੇ ਹਰ ਕ੍ਰਿਕਟ ਦਾ ਹਰ ਸਮਾਨ ਪਿਆ ਆ ਬੋਲ ਤੋਂ ਲੈ ਕੇ ਬੈਟ ਬੋਲ ਬੈਟ ਵਿਕਟਾਂ ਕੀਪਿੰਗ ਗਲਵਜ਼ ਅਤੇ ਪੂਰੀ ਦੀ ਪੂਰੀ ਕਿੱਟ ਹੀ ਭਰੀ ਪਈ ਹੈ ਮੈਂ ਦੋ ਤਿੰਨ ਕਿੱਟਾਂ ਦਾ ਮੈਂ ਵੈਸੇ ਹੀ ਪਰਚੇਸ ਕਰ ਲਿਆਇਆ ਸੀਗਾ ਜਦੋਂ ਮੇਨਾ ਖੇਡਦਾ ਸੀਗਾ ਖੇਡਦਾ ਤਾਂ ਮੈਂ ਅੱਜ ਵੀ ਹਾਂ ਪਰ ਛੋਟੇ ਹੁੰਦਿਆਂ ਦੀ ਖੇਡ ਕੁਛ ਔਰ ਹੀ ਸੀਗਾ ਜਦੋਂ ਛੋਟੇ ਹੁੰਦਿਆਂ ਸਕੂਲ ਵੀ ਜਾਂਦੇ ਸਾਂ ਤਾਂ ਸਕੂਲ ਤੋਂ ਵਾਪਸ ਆਉਂਦਿਆਂ ਹੀ ਬੈਟ ਅਤੇ ਆਪਣੀ ਕਿੱਟ ਚੁੱਕ ਕੇ ਖੇਡਣ ਲਈ ਚਲੇ ਜਾਈਦਾ ਸੀਗਾ ਉਸ ਟਾਈਮ ਆਪਾਂ ਨਾ ਧੁੱਪ ਦੇਖਦੇ ਸੀਗੇ ਨਾ ਹੀ ਠੰਡ ਸਾਈਕਲ ਹੁਣ ਕੋਲ ਹੁੰਦਾ ਸੀਗਾ ਸਾਈਕਲ ਚੁੱਕੀ ਦਾ ਸੀਗਾ ਅਤੇ ਗਰਾਊਂਡ ਚਲੇ ਜਾਈਦਾ ਸੀਗਾ ਬੈਟਸਮੈਨ ਅਗਰ ਕ੍ਰਿਕਟ ਦੀ ਗੱਲ ਕੀਤੀ ਜਾਏ ਕ੍ਰਿਕਟ ਦੇ ਬਹੁਤ ਹੀ ਖ਼ਾਸ ਖ਼ਾਸ ਨਿਯਮ ਹੁੰਦੇ ਹਨ ਕੈਚ ਹੋਣ 'ਤੇ ਆਊਟ ਦੇ ਦਿੱਤਾ ਜਾਂਦਾ ਹੈ ਅਤੇ ਭੱਜਦੇ ਭੱਜਦੇ ਨਾ ਕਰੀਸ ਤੱਕ ਨਾ ਪਹੁੰਚੋ ਤਾਂ ਰਨ ਆਊਟ ਜੋ ਕਿ ਇਹਦੇ ਵਿੱਚ ਰੋਂਦੀ ਵੀ ਬਹੁਤ ਜ਼ਿਆਦਾ ਹੀ ਚਲਦੀ ਹੈ ਆਪਸ ਵਿੱਚ ਖੇਡਿਆ ਜਾਵੇ ਤਾਂ ਕਈ ਲੋਕ ਇਹਦੇ ਵਿੱਚ ਰੋਂਦੀ ਵੀ ਬਹੁਤ ਹੀ ਜ਼ਿਆਦਾ ਮਾਰਦੇ ਹਨ ਮੇਰੀ ਅ ਬੋਲਿੰਗ ਅਤੇ ਬੈਟਿੰਗ ਵਿੱਚੋਂ ਮੈਨੂੰ ਪਸ ਮਨਪਸੰਦ ਬੈਟਿੰਗ ਕਰਨਾ ਹੈ ਮੈਂ ਬੋਲਰ ਨਹੀਂ ਹਾਂ ਬੋਲਿੰਗ ਮੇਰੇ ਕੋਲ ਹੁੰਦੀ ਨਹੀਂ ਹੈ ਬੈਟਸਮੈਨ ਵਿੱਚ ਮੈਂ ਓਪਨਿੰਗ ਬੈਟਸਮੈਨ ਹਾਂ ਜੋ ਕਿ ਸਟਾਰਟਿੰਗ ਵਿੱਚ ਹੀ ਪਹਿਲੇ ਓਵਰ ਤੋਂ ਹੀ ਖੇਡਦਾ ਹੈ ਅਤੇ ਕਈ ਕਈ ਵਾਰੀ ਸੌ ਸੌ ਰਨ ਵੀ ਬਣਾ ਚੁੱਕਾ ਹਾਂ ਸੌ ਰਨ ਨੂੰ ਇਹਦੇ ਵਿੱਚ ਸੈਂਚਰੀ ਕਿਹਾ ਜਾਂਦਾ ਹੈ ਅਤੇ ਪੰਜਾਹ ਨੂੰ ਹਾਫ ਸੈਂਚਰੀ ਕਿਹਾ ਜਾਂਦਾ ਹੈ ਹਾਫ ਅਗਰ ਅੱਜ ਤੱਕ ਦੀ ਮੈਂ ਗੱਲ ਕੀਤੀ ਜਾਏ ਤਾਂ ਪਤਾ ਨਹੀਂ ਕਿੰਨੀਆਂ ਹਾਫ ਸੈਂਚਰੀਆਂ ਅਤੇ ਕਿੰਨੀਆਂ ਹੀ ਸੈਂਚਰੀਆਂ ਲੱਗਾ ਚੁੱਕਿਆ ਹਾਂ ਅਗਰ ਮਨਪਸੰਦ ਖੇਡ ਦੀ ਗੱਲ ਕੀਤੀ ਜਾਏ ਤਾਂ ਮੇਰੀ ਮਨਪਸੰਦ ਖੇਡ ਅੱਜ ਵੀ ਇੱਕੋ ਹੀ ਹੈ ਕ੍ਰਿਕਟ ਅੱਗੇ ਅਤੇ ਪਹਿਲਾਂ ਵੀ ਇੱਕੋ ਹੀ ਸੀਗਾ ਕ੍ਰਿਕਟ